ਸਤਿ ਸ਼੍ਰੀ ਅਕਾਲ ਮੇਰਾ ਨਾਂ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਮੈਨੂੰ ਨਾ ਕੱਲ੍ਹ ਇੱਕ ਮੈਸੇਜ ਆਇਆ ਸੀ ਜਿਸ ਜਿਸ ਵਿੱਚ ਦੱਸਿਆ ਗਿਆ ਸੀ ਕਿ ਤੁਹਾਡਾ ਇਨਕਮ ਟੈਕਸ ਕੋਲੋਂ ਰਿਫੰਡ ਲੈਣਾ ਰਹਿ ਗਿਆ ਹੈ ਮੇਰੇ ਮੇਰਾ ਤਿੰਨ ਲੱਖ ਦਾ ਰਿਫੰਡ ਮੈਨੂੰ ਵਾਪਸ ਕਰ ਦਿੱਤਾ ਜਾਵੇ ਮੇਰੇ ਖਾਤਾ ਨੰਬਰ ਐਚ ਡੀ ਐਫ ਸੀ ਬੈਂਕ ਦਾ ਹੈ ਮੇਰਾ ਖਾਤਾ ਮੇਰਾ ਬੈਂਕ ਅਕਾਊਂਟ ਐਚ ਡੀ ਐਫ ਸੀ ਦਾ ਹੈ ਮੇਰਾ ਬੈਂਕ ਅਕਾਉਂਟ ਦਾ ਨੰਬਰ ਚਾਰ ਪੰਜ ਤਿੰਨ ਦੋ ਇੱਕ ਨੌ ਇੱਕ ਚਾਰ ਤਿੰਨ ਦੋ ਇੱਕ ਹੈ ਤੁਸੀਂ ਇਸ ਵਿੱਚ ਮੈਨੂੰ ਮੇਰਾ ਰਿਫੰਡ ਵਾਪਸ ਕਰ ਦੇ ਕਰ ਸਕਦੇ ਹੋ ਮੈਨੂੰ ਮੈਸਿਜ ਰਾਹੀਂ ਕੱਲ੍ਹ ਦੱਸਿਆ ਗਿਆ ਹੈ ਕਿ ਤੁਹਾਡਾ ਇਨਕਮ ਟੈਕਸ ਕੋਲੋਂ ਇੰਨਾ ਰਿਫਰੈਂਡ ਲੈਣਾ ਰਹਿ ਗਿਆ ਹੈ ਤਾਂ ਮੈਨੂੰ ਮੈਨੂੰ ਘਰ ਵਿੱਚ ਮੈਨੂੰ ਮੇਰੇ ਬਿਜਨਸ ਵਿੱਚ ਵੀ ਬਹੁਤ ਲੋਸ ਹੋ ਰਿਹਾ ਹੈ ਤਾਂ ਕਰਕੇ ਮੈਂ ਇਸ ਨੂੰ ਆਪਣੇ ਬਿਜਨਸ ਵਿੱਚ ਮੈਂ ਇਸਨੂੰ ਆਪਣੇ ਘਰ ਵਿੱਚ ਵਰਤ ਸਕਦਾ ਹਾਂ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰ ਸਕਦਾ ਹਾਂ ਕਿ ਮੈਨੂੰ ਇਹ ਵਾਪਸ ਕਰ ਦਿੱਤਾ ਜਾਵੇ ਕਿਉਂਕਿ ਇਹ ਵਾਪਸ ਕਰਨ ਨਾਲ ਹੀ ਮੈਂ ਆਪਣੇ ਬਿਜਨਸ ਵਿੱਚ ਵਾਧਾ ਪਾ ਸਕਦਾ ਅਤੇ ਮੈਂ ਆਪਣੇ ਘਰ ਵਿੱਚ ਬਿਜਨਸ ਵਿੱਚ ਹੋਇਆ ਲੋਸ ਨੂੰ ਮੈਂ ਲੋਸ ਨੂੰ ਪ੍ਰੋਫਿਟ ਵਿੱਚ ਕਰ ਸਕਦਾ ਹਾਂ ਇਹ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਸ ਵਧੀਆ ਤਰੀਕੇ ਨਾਲ ਵਰਤਣਾ ਚਾਹੁੰਦਾ ਮੈਂ ਇਸ ਨੂੰ ਮੈਨੂੰ ਮੇਰਾ ਐਚ ਡੀ ਐਫ ਸੀ ਮੇਰਾ ਆਈ ਐਫ ਸੀ ਕੋਡ ਵੀਹ ਏਟ ਨਾਈਨ ਜੀਰੋ ਜੀਰੋ ਫਾਈਬ ਫ਼ੋਰ ਥ੍ਰੀ ਟੂ ਸਿਕਸ ਵੰਨ ਏਟ ਨਾਈਨ ਫ਼ੋਰ ਏਟ ਟੂ ਸਿਕਸ ਹੈ ਜੇ ਤੁਸੀਂ ਹੋਰ ਵੀ ਕੁਛ ਮੈਨੂੰ ਮੇਰੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਹੋਰ ਵੀ ਆਪਣੀ ਡਿਟੇਲ ਦੇ ਸਕਦਾ ਹਾਂ ਤੁਸੀਂ ਬਸ ਕਿਰਪਾ ਕਰਕੇ ਮੈਨੂੰ ਮੇਰਾ ਬਕਾਇਆ ਵਾਪਸ ਕਰ ਦਿੱਤਾ ਜਾਵੇ ਮੈਂ ਆਪ ਜੀ ਦਾ ਬਹੁਤ ਹੀ ਆਗਿਆਕਾਰੀ ਧੰਨਵਾਦੀ ਹੋਵਾਂਗਾ ਮੈਂ ਮੇਰੇ ਕੋਲੋਂ ਹੁਣ ਤੁਹਾਡੇ ਬੋਲਣ ਲਈ ਹੋਰ ਕੋਈ ਲਫਜ਼ ਨਹੀਂ ਹੈਗਾ ਮੈਂ ਤੁਹਾਨੂੰ ਕੀ ਦੱਸ ਸਕਦਾ ਹਾਂ ਪਰ ਮੈਨੂੰ ਕਿਰਪਾ ਕਰਕੇ ਮੈਨੂੰ ਮੇਰਾ ਟੈਕਸ ਇਨਕਮ ਟੈਕਸ ਤੋਂ ਫੰਡ ਵਾਪਸ ਕਰ ਦਿੱਤਾ ਜਾਵੇ ਇਹ ਵ ਟੈਕ ਇਨਕਮ ਟੈਸਟ ਤੋਂ ਫੰਡ ਵਾਪਸ ਹੋਣ ਨਾਲ ਮੈਂ ਆਪਣੇ ਆ ਘਰ ਵਿੱਚ ਵੀ ਲਾ ਸਕਦਾ ਅਤੇ ਮੈਂ ਆਪਣੇ ਬਿਜਨਸ ਵਿੱਚ ਵੀ ਪ੍ਰੋਫਿਟ ਕਰ ਸਕਦਾ ਹਾਂ